ਸਤਿ ਸ਼੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਸਾਡੇ ਜ਼ਿਲ੍ਹੇ ਵਿੱਚ ਸਥਾਨੀਏ ਕਲਾਕਾਰ ਅਤੇ ਸ਼ਿਲਪਕਾਰ ਆਉਂਦੇ ਨੇ ਅਤੇ ਉਹ ਕੈਂਪ ਲਗਾਉਂਦੇ ਨੇ ਉਹ ਕੈਂਪ ਬਹੁਤ ਹੀ ਵਧੀਆ ਹੁੰਦਾ ਹੈ ਉਸ ਕੈਂਪ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਸ ਕੈਂਪ ਵਿੱਚ ਹਰ ਉਮਰ ਦੇ ਬੱਚੇ ਨੂੰ ਵੱਖਰਾ ਕੁਝ ਨਵਾਂ ਜ਼ਰੂਰ ਸਿਖਾਇਆ ਜਾਂਦਾ ਹੈ ਉਸ ਕੈਂਪ ਵਿੱਚ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਅਤੇ ਉਹ ਕੈਂਪ ਵਿੱਚ ਬਿਲਕੁਲ ਸਮੇਂ ਦਾ ਸਹੀ ਉਪਯੋਗ ਕੀਤਾ ਜਾਂਦਾ ਹੈ ਉਸ ਕੈਂਪ ਵਿੱਚ ਜਿਹੜੇ ਕਲਾਕਾਰ ਅਤੇ ਸ਼ਿਲਪਕਾਰ ਹੁੰਦੇ ਨੇ ਉਹ ਬਹੁਤ ਹੀ ਸਹੀ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਸਮਝਾਉਂਦੇ ਨੇ ਉਹ ਕੈਂਪ ਵਿੱਚ ਹਰ ਕੋਈ ਬਿਲ ਪੂਰੀ ਸਹੀ ਤਰੀਕੇ ਨਾਲ ਯੋ ਆਪਣਾ ਯੋਗਦਾਨ ਦਿੰਦਾ ਹੈ ਉਹ ਕੈਂਪ ਦੇ ਬਾਅਦ ਸਾਨੂੰ ਖਾਣ ਨੂੰ ਰੋਟੀ ਵੀ ਦਿੱਤੀ ਜਾਂਦੀ ਹੈ ਉਹ ਕੈਂਪ ਵਿੱਚ ਜਿਸ ਬੱਚੇ ਨੂੰ ਕਿਸੇ ਚੀਜ਼ ਵਿੱਚ ਵੱਧ ਰੁਚੀ ਹੋਵੇ ਤਾਂ ਉਹ ਕਲਾਕਾਰ ਉ ਉਸ ਬੱਚੇ ਨੂੰ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਸ ਬੱਚੇ ਨੂੰ ਉਹ ਅੱਗੇ ਤੋਂ ਅੱਗੇ ਤੱਕ ਲੈ ਕੇ ਜਾ ਸਕੇ ਮੈਂ ਤਾਂ ਬਸ ਇਹੀ ਕਹਾਂਗਾ ਕਿ ਇਹ ਇਹ ਕਲਾਕਾਰ ਜਿਹੜੇ ਕੈਂਪ ਲਗਾਉਂਦੇ ਨੇ ਇਹ ਬਹੁਤ ਹੀ ਵਧੀਆ ਹੁੰਦੇ ਨੇ ਅਤੇ ਹਰ ਬੰਦੇ ਨੂੰ ਇਹ ਕੈਂਪ ਜ਼ਰੂਰ ਲਗਾਉਣਾ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਵੀ ਲਗਵਾਉਣਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ